ਅੱਜ ਦੇ ਜ਼ਮਾਨੇ ਵਿੱਚ ਪੰਦਾ ਪੰਜਾਬ ਵਿੱਚ ਸਿੱਖਿਆ ਦਾ ਸਤਰ ਬਹੁਤ ਹੀ ਉੱਚਾ ਹੋ ਚੁੱਕਾ ਹੈ ਅਤੇ ਬਹੁਤ ਹੀ ਚੰਗੇ ਕਾਲਜ ਅਤੇ ਸਕੂਲਾਂ ਨੂੰ ਵੀ ਨਿਰਮਾਣਿਤ ਕੀਤਾ ਗਿਆ ਹੈ ਅੱਜ ਕੱਲ੍ਹ ਪੰਜਾਬ ਦੇ ਸਕੂਲਾਂ ਵਿੱਚ ਬਹੁਤ ਹੀ ਚੰਗੇ ਤਰੀਕਿਆਂ ਨਾਲ ਬਹੁਤ ਹੀ ਵਧੀਆ ਬੱਚਿਆਂ ਦਾ ਬੈਠਣ ਦਾ ਅਤੇ ਉਹਨਾਂ ਨੂੰ ਪੜ੍ਹਾਉਣ ਦਾ ਇਕਦਮ ਵਧੀਆ ਬੰਦੋਬਸਤ ਕੀਤਾ ਜਾਂਦਾ ਹੈ ਅਤੇ ਹਰੇਕ ਸਕੂਲਾਂ ਅਤੇ ਕਾਲਜਾਂ ਵਿੱਚ ਵਧੀਆ ਪੜ੍ਹੇ ਲਿਖੇ ਟੀਚਰ ਜੋ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਣ ਉਹਨਾਂ ਨੂੰ ਹੀ ਟੀਚਰ ਦਾ ਦਰਜਾ ਦਿੱਤਾ ਜਾਂਦਾ ਹੈ ਪੰਜਾਬ ਵਿੱਚ ਕਾਫੀ ਨਾਮੀ ਕਾਲਜ ਅਤੇ ਸਕੂਲ ਵੀ ਰਹੇ ਹਨ ਜਿਵੇਂ ਕਿ ਰਿਆਤ ਐਂਡ ਬਹਾਰਾ ਯੂਨੀਵਰਸਟੀ ਚੰਡੀਗੜ੍ਹ ਯੂਨੀਵਰਸਿਟੀ ਅਤੇ ਇੱਕ ਆਈ ਆਈ ਟੀ ਰੋਪੜ ਜੋ ਕਿ ਪੂਰੇ ਭਾਰਤ ਵਿੱਚ ਨੰਬਰ ਇੱਕ ਦਰਜਾ ਪ੍ਰਾਪਤ ਕਰਦੀ ਹੈ ਅਤੇ ਇਹਨਾਂ ਵਧੀਆ ਵਧੀਆ ਇੰਸਟੀਟਿਊਟਾਂ ਅਤੇ ਕਾਲਜਾਂ ਕਰਕੇ ਹੀ ਪੰਜਾਬ ਦਾ ਸਤਰ ਬਹੁਤ ਉੱਚਾ ਹੈ ਅਤੇ ਇਸ ਵਿੱਚ ਪੜ੍ਹਾਈ ਦੇ ਖੇਤਰ ਵਿੱਚ ਬਹੁਤ ਹੀ ਵਧੀਆ ਵਧੀਆ ਟੀਚਰਾਂ ਨੇ ਵੀ ਬਹੁਤ ਸਾਰੇ ਐਦ ਇਹੋ ਜਿਹੇ ਸਟੂਡੈਂਟ ਨਿਕਲੇ ਹਨ ਜੋ ਕਿ ਅੱਗੇ ਜਾ ਕੇ ਬਹੁਤ ਚੰਗੀ ਜਾਂ ਤਾਂ ਜੋਬ ਕਰ ਰਹੇ ਹਨ ਜਾਂ ਤਾਂ ਦੁਨੀਆਂ ਵਿੱਚ ਬਹੁਤ ਵੱਡੀ ਹਸਤੀਆਂ ਬਣ ਚੁੱਕਾ ਹਨ